ਪੰਜਾਬ ਵਿੱਚ ਬਹੁਤ ਹੀ ਪ੍ਰਮੁੱਖ ਖੇਡ ਅਕੈਡਮੀਆਂ ਹਨ ਜਾਂ ਸਿਖਲਾਈ ਕੇਂਦਰ ਹਨ ਜੋ ਕਿ ਖਿਡਾਰੀਆਂ ਨੂੰ ਕੋਚਿੰਗ ਅਤੇ ਸਿਖਲਾਈ ਪ੍ਰਦਾਨ ਕਰਦੇ ਹਨ ਜਿਵੇਂ ਕੀ ਸ਼ਹੀਦ ਏ ਆਜ਼ਮ ਸਪੋਰਟਸ ਅਕੈਡਮੀ ਇੱਥੇ ਖਿਡਾਰੀਆਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਮਿਲਦੀਆਂ ਹਨ ਉਹਨਾਂ ਦੀ ਟ੍ਰੇਨਿੰਗ ਕਰਵਾਉਂਦੇ ਹਨ ਬੈਡਮਿੰਟਨ ਹੋ ਗਿਆ ਕਬੱਡੀ ਹੋ ਗਈ ਐਥਲੈਟਿਕਸ ਹੋ ਗਈ ਇਹ ਸਾਰੀਆਂ ਖੇਡਾਂ ਉਹਨਾਂ ਨੂੰ ਉੱਥੇ ਪ੍ਰੈਕਟਿਸ ਕਰਵਾਈ ਜਾਂਦੀ ਹੈ ਅਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਹੂਲਤਾਂ ਮਿਲਦੀ ਹੈ ਜਿਵੇਂ ਕਿ ਇਹਨਾਂ ਨੂੰ ਅੱਗੇ ਖੇਡਣ ਲਈ ਵੀ ਮਿਲਦਾ ਹੈ ਅੱਗੇ ਜਿੱਦਾਂ ਸਟੇਟ ਡਿਸਟਰੀਕ ਹੋ ਗਿਆ ਨੈਸ਼ਨਲ ਇੰਟਰਨੈਸ਼ਨਲ ਉੱਥੇ ਵੀ ਇਹਨਾਂ ਨੂੰ ਵੱਖ ਵੱਖ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇਹਨਾਂ ਨੂੰ ਮਤਲਬ ਵਧੀਆ ਤਰੀਕੇ ਨਾਲ ਇਹਨਾਂ ਦਾ ਖਾਣ ਪੀਣ ਸਭ ਕੁਛ ਉਹਨਾਂ ਦਾ ਹੁੰਦਾ ਹੈ ਅਤੇ ਇਹਨਾਂ ਨੂੰ ਬੜੇ ਹੀ ਵਧੀਆ ਸਿਖਲਾਈ ਦਿੱਤੀ ਜਾਂਦੀ ਹੈ ਉੱਥੇ ਸਾਰੇ ਹੀ ਬਹੁਤ ਹੀ ਮਨ ਲਾ ਕੇ ਖੇਡਦੇ ਹਨ ਅਤੇ ਆਪਣੀ ਪ੍ਰੈਕਟਿਸ ਕਰਦੇ ਹਨ ਜਿੱਦਾਂ ਕਿ ਐਥਲੈਟਿਕਸ ਇਹਨਾਂ ਨਾਲ ਖੇਡ ਕੇ ਸਾਡਾ ਸਰੀਰ ਵੀ ਵਧੀਆ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਇਸ ਕਰਕੇ ਸਾਨੂੰ ਵੀ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ